ਮੈ ਰਜੇਸ਼ ਕੁਮਾਰ ਵਾਸੀ ਫਿਰੋਜ਼ਪੁਰ ਕਲਾਂ ਪਠਾਨਕੋਟ ਜ਼ਿਲ੍ਹੇ ਦਾ ਵਸਨੀਕ ਹਾਂ ਮੈਂ ਇਹ ਗੱਲ ਜਾਣਦਾ ਹਾਂ ਕਿ ਮੇਰਾ ਪੰਜਾਬੀ ਵਿਸ਼ਾ ਹੋਣ ਕਰਕੇ ਮੇਰੇ ਕਈ ਮਨਪਸੰਦ ਲੇਖਕ ਹਨ ਪਰ ਉਹਨਾਂ ਵਿੱਚੋਂ ਸਭ ਦੇ ਵਿੱਚੋਂ ਇੱਕ ਮੇਰੇ ਪਿਆਰੇ ਲੇਖਕ ਡਾਕਟਰ ਲੇਖ ਰਾਜ ਜੀ ਹਨ ਜਿਨ੍ਹਾਂ ਨੇ ਬੜੀ ਮਿਹਨਤ ਸਦਕਾ ਆਪਣਾ ਜਿਹੜਾ ਰੁਤਬਾ ਹੈ ਉਹ ਵਧੀਆ ਕੀਤਾ ਹੈ ਉਹ ਅੱਜ ਪੰਜਾਬੀ ਭਾਸ਼ਾ ਵਿੱਚ ਕਿੰਨੇ ਮੁਹਾਰਤ ਹਾਸਲ ਕਰ ਚੁੱਕੇ ਹਨ ਕਿ ਉਨਾਂ ਨੇ ਕੋਈ ਦਰਜਨ ਦੇ ਕਰੀਬ ਕਹਾਣੀਆਂ ਗਜ਼ਲਾਂ ਕਵਿਤਾਵਾਂ ਅਤੇ ਆਦਿ ਲਿਖੇ ਹਨ ਉਹ ਬੜੇ ਹੀ ਵਧੀਆ ਲੇਖਕ ਹਨ ਕਿ ਉਹਨਾਂ ਦੀ ਗਜ਼ਲ ਦੀ ਆਵਾਜ਼ ਬੜੀ ਹੀ ਮਧੁਰ ਹੈ ਜਿਹੜੀ ਕਿ ਸਰੋਤਿਆਂ ਲਈ ਮੋਹ ਲੈਂਦੀ ਹੈ ਧੰਨਵਾਦ